ਸਰਕਾਰ ਵੱਲੋਂ ਜੋ ਕਿ ਆਮ ਜਨਤਾ ਦੇ ਲਈ ਉਹਨਾਂ ਦੇ ਲਈ ਖੁਰਾਕ ਦੀ ਵੰਡ ਲਈ ਸਰਕਾਰ ਨੇ ਬਹੁਤ ਸਾਰੀਆਂ ਨੀਤੀਆਂ ਲਾਗੂ ਕਰ ਕੀਤੀਆਂ ਹਨ ਜਿਵੇਂ ਕਿ ਆਪਾਂ ਗੱਲ ਕਰੀਏ ਤਾਂ ਇੱਕ ਰਾਸ਼ਨ ਕਾਰਡ ਅਤੇ ਅਤੇ ਪਰਿਵਾਰ ਦੇ ਜਿੰਨੇ ਵੀ ਮੈਂਬਰ ਹਨ ਉਹਨਾਂ ਸਾਰਿਆਂ ਨੂੰ ਜੋ ਕਿ ਰਾਸ਼ਨ ਮਿਲਦਾ ਹੈ ਸੋ ਕਈ ਵਾਰ ਕੀ ਹੁੰਦਾ ਹੈ ਕਿ ਪਿੱਛੋਂ ਸਪਲਾਈ ਨਾ ਆਉਣ ਕਰਕੇ ਸਹੀ ਟਾਈਮ 'ਤੇ ਰਾਸ਼ਨ ਨਹੀਂ ਪਹੁੰਚ ਸਕਦਾ ਹੈ ਸੋ ਇਸ ਕਰਕੇ ਜਿਹੜੇ ਵਿਚਾਰੇ ਗਰੀਬ ਪਰਿਵਾਰ ਹਨ ਉਹਨਾਂ ਨੂੰ ਖਾਣ ਲਈ ਰਾਸ਼ਨ ਨਹੀਂ ਮਿਲਦਾ ਇਹ ਸਭ ਤੋਂ ਵੱਡੀ ਸਮੱਸਿਆ ਹੈ ਅਤੇ ਉਸ ਤੋਂ ਬਾਅਦ ਇੱਕ ਹੋਰ ਇਹ ਸਮੱਸਿਆ ਹੈ ਕਿ ਕਿ ਅਗਰ ਕਿਸੇ ਨੂੰ ਵੀ ਰਾਸ਼ਨ ਲੈਣਾ ਹੈ ਤਾਂ ਉਹਨਾਂ ਨੂੰ ਰਾਸ਼ਨ ਜੋ ਕਿ ਸੈਂਟਰ ਬਣਿਆ ਹੋਇਆ ਉੱਥੇ ਜਾਣਾ ਪੈਂਦਾ ਹੈ ਅਤੇ ਉੱਥੇ ਬਹੁਤ ਸਾਰੇ ਸਮੇਂ ਦੀ ਬਰਬਾਦੀ ਹੁੰਦੀ ਹੈ ਅਤੇ ਕਈ ਵਾਰ ਔਨਲਾਈਨ ਜਿੱਦਾਂ ਜਿਵੇਂ ਕਰਦੇ ਹਾਂ ਤਾਂ ਉਹ ਸਹੀ ਨਹੀਂ ਹੁੰਦਾ ਅੰਗੂਠਾ ਨਹੀਂ ਲੱਗਦਾ ਸੋ ਇਸ ਕਰਕੇ ਇਹ ਖੁਰਾਕ ਦੀ ਵੰਡ ਲਈ ਸਰਕਾਰ ਵਲੋਂ ਨੀਤੀਆਂ ਬਣਾਈਆਂ ਜਾਣ ਪਰ ਇਸ ਵਿੱਚ ਬਹੁਤ ਸਾਰੀ ਸਮੱਸਿਆ ਦਾ ਸਾਹਮਣਾ ਜੋ ਕਿ ਆਮ ਜਨਤਾ ਨੂੰ ਕਰਨਾ ਪੈਂਦਾ ਹੈ ਥੈਂਕ ਯੂ ਸੋ ਮੱਚ